ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮੈਨੂੰ ਤੁਹਾਡੀ ਜੋ ਵੈੱਬਸਾਈਟ ਤੋਂ ਮੰਗਵਾਇਆ ਗਿਆ ਜੋ ਪਲਾਸ ਸੀ ਮੈਨੂੰ ਬਹੁਤ ਪਸੰਦ ਆਇਆ ਅਤੇ ਮੇਰੇ ਬਹੁਤ ਜ਼ਿਆਦਾ ਕੰਮ ਆ ਰਿਹਾ ਇਸ ਪਲਾਸ ਦੀ ਮਦਦ ਨਾਲ ਮੇਰੇ ਸਾਰੇ ਕੰਮ ਵਧੀਆ ਹੋ ਰਹੇ ਆ ਕਿਉਂਕਿ ਮੈਂ ਇੱਕ ਬਿਜਲੀ ਦਾ ਮਕੈਨਿਕ ਹਾਂ ਸੋ ਬਿਜਲੀ ਵਾਲਿਆਂ ਨੂੰ ਪਲਾਸ ਦੀ ਬਹੁਤ ਲੋੜ ਪੈਂਦੀ ਹੈ ਇਸ ਪਲਾਸ ਦੀ ਮਦਦ ਨਾਲ ਮੇਰਾ ਕੰਮ ਵੀ ਵਧੀਆ ਹੁੰਦਾ ਹੈ ਅਤੇ ਇਸਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਅਤੇ ਇਸਦੀ ਡਿਲੀਵਰੀ ਵੀ ਮੈਨੂੰ ਬਹੁਤ ਜਲਦੀ ਮਿਲ ਗਈ ਸੀ ਲਿਖਿਆ ਤਿੰਨ ਦਿਨ ਸੀ ਪਰ ਮੈਨੂੰ ਦੋ ਦਿਨ ਦੇ ਵਿੱਚ ਹੀ ਇਸਦੀ ਡਿਲੀਵਰੀ ਪ੍ਰਾਪਤ ਹੋ ਗਈ ਸੀ ਅਤੇ ਜੋ ਡਿਲੀਵਰੀ ਕਰਨ ਆਇਆ ਬੰਦਾ ਸੀ ਉਹ ਵੀ ਬਹੁਤ ਵਧੀਆ ਸੁਭਾਅ ਦਾ ਸੀ ਰਾਜੇਸ਼ ਨਾਮ ਦਾ ਉਹ ਬੰਦਾ ਸੀ ਬਹੁਤ ਵਧੀਆ ਸੁਭਾਅ ਸੀ ਉਸਦਾ ਅਤੇ ਬਾਕੀ ਰਹੀ ਡਿਲੀਵਰੀ ਦੀ ਗੱਲ ਡਿਲੀਵਰੀ ਦੀ ਪੈਕਿੰਗ ਵੀ ਬਹੁਤ ਵਧੀਆ ਸੀ ਅਤੇ ਜੋ ਬਾਕੀ ਪਲਾਸ ਹੁੰਦੇ ਹਨ ਉਹਨਾਂ ਦੀ ਕੁਆਲਿਟੀ ਥੋੜ੍ਹੀ ਖਰਾਬ ਹੁੰਦੀ ਹੈ ਪਰ ਜੋ ਤੁਹਾਡਾ ਪਲਾਸ ਹੈ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਅਤੇ ਮੈਂ ਤੁਹਾਡੀ ਇਸ ਪਲਾਸ ਦੀ ਕੰਪਨੀ ਦੇ ਵਿੱਚ ਜਾ ਕੇ ਰੇਟਿੰਗ ਪੰਜ ਰੇਟਿੰਗ ਕਰੂੰਗਾ ਅਤੇ ਆਪਣੇ ਹੋਰ ਵੀ ਦੋਸਤਾਂ ਨੂੰ ਕਹਾਂਗਾ ਕਿ ਜੇਕਰ ਕੋਈ ਵੀ ਪ੍ਰੋਡਕਟ ਮੰਗਵਾਉਣਾ ਹੋਵੇ ਉਹ ਤੁਹਾਡੀ ਕੰਪਨੀ ਤੋਂ ਹੀ ਮੰਗਵਾਉਣ ਖਾਸ ਕਰਕੇ ਪਲਾਸ ਕਿਉਂਕਿ ਪਲਾਸ ਤਾਂ ਮੈ ਖੁਦ ਯੂਜ ਕਰਕੇ ਦੇਖ ਚੁੱਕਾ ਹਾਂ